ਹੈਲੋ ਹਾਂਜੀ ਸਵੀਗੀ ਐਪ ਤੋਂ ਬੋਲ ਰਹੇ ਹੋ ਸਰ ਮੈਂ ਆਪਣੇ ਸਵੀਗੀ 'ਤੇ ਨਾ ਇੱਕ ਔਡਰ ਕੀਤਾ ਸੀ ਖਾਣੇ ਦਾ ਮੇਰੇ ਘਰ ਗੈਸਟ ਆਉਣੇ ਸੀਗੇ ਉਹਦੇ ਲਈ ਮੈਂ ਤੁਹਾਡੇ ਖਾਣੇ ਦਾ ਔਡਰ ਕੀਤਾ ਸੀਗਾ ਔਰ ਇੰਨਾ ਟਾਈਮ ਹੋ ਗਿਆ ਹੈ ਮੀਨਜ਼ ਉਹ ਔਡਰ ਤਾਂ ਮੇਰੇ ਕੋਲ ਪਹੁੰਚਿਆ ਨਹੀਂ ਠੀਕ ਹੈ ਮੇਰੇ ਗੈਸਟ ਆ ਕੇ ਘਰ ਵਾਪਿਸ ਵੀ ਚਲੇ ਗਏ ਠੀਕ ਹੈ ਮੈਂ ਇੰਨਾ ਕੁਛ ਖਾਣ ਲਈ ਕੀਤਾ ਸਪੈਸ਼ਲੀ ਇੰਨਾ ਸੁਬਾਹ ਮੌਰਨਿੰਗ ਔਡਰ ਪਾਇਆ ਸੀ ਤਾਂ ਜੋ ਦੁਪਹਿਰ ਤੱਕ ਆ ਸਕੇ ਮੇਰਾ ਔਡਰ ਠੀਕ ਹੈ ਗੈਸਟ ਆ ਜਾਣ ਅਤੇ ਮੈਂ ਉਹਨਾਂ ਨੂੰ ਅੱਛਾ ਖਾਣਾ ਖਿਲਾ ਸਕਾਂ ਕਿਉਂਕਿ ਮੈਂ ਪਹਿਲਾਂ ਵੀ ਕਾਫ਼ੀ ਟਾਈਮ ਮੰਗਵਾਇਆ ਹੈਗਾ ਠੀਕ ਹੈ ਮੀਨਜ਼ ਦਿੱਕਤ ਤਾਂ ਆਉਂਦੀ ਹੈ ਪਰ ਐਨੀ ਨਹੀਂ ਆਈ ਕਦੇ ਮੀਨਜ਼ ਅੱਜ ਤਾਂ ਤੁਸੀਂ ਸਮਝ ਹੀ ਸਕਦੇ ਹੋ ਇਹ ਵੀ ਜਦੋਂ ਕੋਈ ਘਰ ਆਇਆ ਹੋਵੇ ਅਤੇ ਇੱਦਾਂ ਦੀ ਕੋਈ ਗੱਲ ਹੋ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਹੈ ਠੀਕ ਹੈ ਖਾਣਾ ਮੰਗਵਾਇਆ ਅਤੇ ਉਹ ਘਰ ਆਏ ਅਤੇ ਖਾਣਾ ਆਇਆ ਨਹੀਂ ਹੈਗਾ ਠੀਕ ਹੈ ਕਿੰਨੀ ਦਿੱਕਤ ਹੋਈ ਹੈ ਮੈਨੂੰ ਦੇਖ ਲਓ ਤੁਸੀਂ ਠੀਕ ਹੈ ਇੰਨੇ ਮੇਰੇ ਦੂਰ ਤੋਂ ਗੈਸਟ ਆਏ ਸੀ ਮੈਨੂੰ ਸਪੈਸ਼ਲ ਇਹ ਸੀ ਵੀ ਚੱਲੋ ਮੈਂ ਇਹਨਾਂ ਨੂੰ ਇੱਦਾਂ ਦਾ ਵਧੀਆ ਖਾਣਾ ਖਵਾਵਾਂ ਠੀਕ ਹੈ ਬਾਹਰ ਲੈ ਕੇ ਜਾਊਂਗੀ ਉੱਦੋਂ ਚੰਗਾ ਵੀ ਚੱਲੋ ਘਰ ਹੀ ਮੰਗਵਾ ਲਿਆ ਘਰ ਬੈਠੇ ਆਸਾਨ ਹੋ ਜਾਂਦਾ ਘਰ ਬੈਠ ਕੇ ਆਰਾਮਦਾਰੀ ਨਾਲ ਖਾ ਲੈਣਗੇ ਆਪਣਾ ਮਜੇ ਨਾਲ ਠੀਕ ਹੈ ਅੱਛਾ ਵੀ ਲੱਗਦਾ ਘਰ ਬਹਿ ਕੇ ਖਾਣਾ ਠੀਕ ਹੈ ਅਤੇ ਪਰ ਤੁਸੀਂ ਦੇਖ ਲਓ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਵੀ ਮੈਂ ਕੈਂਸਲ ਕਰਵਾਉਣਾ ਚਾਹੁੰਦੀ ਹੈਗੀ ਇਸ ਔਡਰ ਨੂੰ ਮੇਰਾ ਮਨ ਨਹੀਂ ਸੀਗਾ ਬਟ ਮੀਨਜ਼ ਜਿੱਦਾਂ ਦਾ ਮੇਰੇ ਨਾਲ ਅੱਜ ਹੋਇਆ ਤਾਂ ਮੈਨੂੰ ਇਹ ਹੀ ਲੱਗ ਰਿਹਾ ਵੀ ਹੁਣ ਕੈਂਸਲ ਹੀ ਕਰਵਾਉਣਾ ਕਿਉਂਕਿ ਹੁਣ ਮੇਰੇ ਕਿਹੜਾ ਇਹ ਕੰਮ ਦਾ ਹੈਗਾ ਗਾ ਇੰਨੀ ਦੇਰ ਖਾਣਾ ਆਇਆ ਨਹੀਂ ਹੈਗਾ ਉਹ ਤਾਂ ਆ ਕੇ ਚਲੇ ਵੀ ਗਏ ਠੀਕ ਹੈ ਕੀ ਫ਼ਾਇਦਾ ਹੋਇਆ ਮੈਨੂੰ ਔਡਰ ਕਰਨ ਦਾ ਜਦੋਂ ਉਹਨਾਂ ਨੇ ਖਾਣਾ ਹੀ ਨਾ ਖਾਦਾ ਠੀਕ ਹੈ ਤਾਂ ਪਲੀਜ ਮੈਂ ਚਾਹੁੰਦੀ ਹਾਂ ਕਿ ਇਹ ਔਡਰ ਤੁਸੀਂ ਕੈਂਸਲ ਕਰ ਦਿਓ ਠੀਕ ਹੈ ਮੈਂ ਹੁਣ ਹੋਰ ਜਗ੍ਹਾਂ ਤੋਂ ਮੰਗਵਾ ਲਿਆ ਸੀ ਠੀਕ ਹੈ ਚੱਲੋ ਜੋ ਕਰਤਾ ਠੀਕ ਹੈ ਨੈਕਸਟ ਟਾਈਮ ਪਲੀਜ਼ ਇੱਦਾਂ ਦਾ ਕੁਛ ਨਾ ਹੋਵੇ ਟਾਈਮ 'ਤੇ ਖਾਣਾ ਆਜੇ ਠੀਕ ਹੈ ਜੀ ਓਕੇ ਥੈਂਕ ਯੂ